ਸਵੇਰੇ ਮੈਂ ਪੰਜ ਵਜੇ ਉੱਠਦਾ ਉਸ ਤੋਂ ਬਾਅਦ ਫਰੈਸ਼ ਹੋ ਕੇ ਦੌੜਨ ਜਾਂਦਾ ਹਾਂ ਅਤੇ ਉਹ ਸਾਡੇ ਘਰ ਤੋਂ ਤਿਨ ਦੋ ਢਾਈ ਦੋ ਕਿਲੋਮੀਟਰ ਪਾਰਕ ਆ ਉੱਥੇ ਜਾ ਕੇ ਡੰਡ ਡੁੰਡ ਨੂੰ ਮਾਰੀ ਦੇ ਆ ਮਿਹਨਤ ਕਰੀ ਦੀ ਆ ਮਿਹਨਤ ਕਰਨ ਤੋਂ ਬਾਅਦ ਫਿਰ ਆਉਣ ਕੇ ਸ ਐਕ ਐਕਸਰਸਾਈਜ਼ ਕਰੀ ਦੀ ਆ ਐਕਸਰਸਾਈਜ਼ ਕਰਕੇ ਘੰਟਾ ਆਰਾਮ ਕਰਕੇ ਫਿਰ ਆਪਣਾ ਡਰਾਈਵਿੰਗ ਦਾ ਕੰਮ ਆ ਉੱਥੇ ਜਾਈਦਾ ਰੱਸੇ ਤਰਪਾਲਾਂ ਪਾਈਦੀਆਂ ਕਿਉਂਕਿ ਮੇਰਾ ਬਹੁਤ ਤਾਕਤ ਵਾਲਾ ਜ਼ੋਰ ਵਾਲਾ ਕੰਮ ਆ ਇਹਦੇ ਨਾਲ ਸਰੀਰ ਬਹੁਤ ਫਿੱਟ ਫਾਟ ਰਹਿੰਦਾ ਆ ਇਸ ਕਰਕੇ ਮੈਂ ਭੱਜਦਾ ਦੋੜਦਾ ਪੂਰਾ ਐਂ ਸਾਰੇ ਕੰਮ ਮੈਂ ਆਪਣੇ ਆਪ ਹੀ ਕਰਦਾ ਹਾਂ ਬਾ